ਹਾਂਜੀ ਸਤਿ ਸ਼੍ਰੀ ਅਕਾਲ ਜੀ

ਹਾਂਜੀ ਹਾਂਜੀ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਦਾ ਜੀ ਇਹ ਇਕ ਇਤਿਹਾਸਿਕ ਸਥਾਨ ਹੈ ਹਾਂਜੀ ਹਾਂ ਇਹ ਫਤਿਹਗੜ੍ਹ ਸਾਹਿਬ ਧਰਤੀ 'ਤੇ ਇਤਿਹਾਸਿਕ ਸਥਾਨ ਹੈ ਜਿੱਥੇ ਕਿ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਜਿਉਂਦੇ ਨੀਹਾਂ ਵਿੱਚ ਚਿਣਵਾ ਦਿੱਤੇ ਗਏ ਸੀ ਹਾਂਜੀ ਅਤੇ ਇਹਨਾਂ ਦੀ ਯਾਦ ਵਿੱਚ ਇੱਥੇ ਇੱਕ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਇਸ ਦੇ ਦਰਸ਼ਨ ਕਰਨੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਜੋ ਕਿ ਅੱਜ ਜਿਸ ਸਮੇਂ ਵਿੱਚ ਇੱਥੇ ਸ਼ਹੀਦੀ ਜੋੜ ਮੇਲਾ ਕਰਾਇਆ ਜਾਂਦਾ ਹੈ ਠੀਕ ਹੈ ਜੀ ਅਤੇ ਇਹ ਤੋਂ ਬਾਅਦ ਹਾਂਜੀ ਹਾਂਜੀ ਬਾਕੀ ਜੀ ਮਾਤਾ ਗੁਜਰੀ ਗੁਰਦੁਆਰਾ ਸਾਹਿਬ ਹੈ ਜੀ ਠੰਡਾ ਬੁਰਜ ਉਹਦੇ ਬੈਕ ਸਾਈਡ 'ਤੇ ਇੱਕ ਮੋਤੀ ਰਾਮ ਮਹਿਰਾ ਦੀ ਯਾਦਗਾਰੀ ਪਾਰਕ ਬਣਾਇਆ ਹੋਇਆ ਜੋ ਕਿ ਬਹੁਤ ਦੇਖਣਯੋਗ ਹੈ ਉਸ ਵਿੱਚ ਇੱਕ ਬਹੁਤ ਬੜਾ ਖੰਡਾ ਬਣਾਇਆ ਗਿਆ ਹੈ ਜੋ ਕਿ ਇੱਥੇ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਇੱਕ ਇੱਥੇ ਆਮ ਖਾਸ ਬਾਗ ਹੈ ਜੀ ਜਿ ਜਿਹੜੀ ਕਿ ਬਹੁਤ ਪੁਰਾਣੀ ਜਿਹੜੀ ਮੁਗਲ ਮੁਗਲ ਟਾਈਮ ਦੀ ਬਹੁਤ ਪੁਰਾਣੀ ਇਮਾਰਤ ਹੈ ਉੱਥੇ ਬਹੁਤ ਸਾਰੀਆਂ ਸ਼ੂਟਿੰਗਾਂ ਹੁੰਦੀਆਂ ਨੇ ਅਤੇ ਦੂਰੋਂ ਦੂਰੋਂ ਉਸ ਨੂੰ ਲੋਕ ਵੇਖਣ ਵਾਸਤੇ ਆਉਂਦੇ ਨੇ ਇੱਕ ਜੀ ਮਾਤਾ ਗੁ ਹਾਂ ਇੱਕ ਮਾਤਾ ਗੁਜਰੀ ਕੋਲਜ ਵਿੱਚ ਪਾਰਕ ਹੈ ਜਿਸ ਨੂੰ ਸਟੂਡੈਂਟ ਇੱਥੇ ਆ ਕੇ ਬਹੁਤ ਅਨੰਦ ਮਾਣਦੇ ਨੇ ਠੀਕ ਹੈ ਜੀ ਓਕੇ